ਬਾਈਕਿੰਗ ਨੂੰ ਜਦੋਂ ਲੋਕਾਂ ਦੇ ਜਾਨੂੰਨ ਵਜੋਂ ਅਸੀਂ ਵਰਣਨ ਕਰਦੇ ਹਾਂ ਤਾਂ ਅਸੀਂ ਇਸ ਤਰੀਕੇ ਨਾਲ ਵਰਣਨ ਕਰ ਸਕਦੇ ਹਾਂ ਇਹ ਇੱਕ ਐਡਵਾਂਚਰਸ ਅਤੇ ਉਤਸ਼ਾਹ ਨਾਲ ਭਰਪੂਰ ਅਨੁਭਵ ਹੈ ਜੋ ਮਨੁੱਖੀ ਜਜ਼ਬੇ ਅਤੇ ਮਜ਼ਬੂਤੀ ਨੂੰ ਸਮਝਾਉਂਦਾ ਹੈ ਬਾਈਕਿੰਗ ਨਾ ਸਿਰਫ ਇੱਕ ਸਰੀਰਕ ਕਸਰਤ ਹੈ ਬਲਕਿ ਇਹ ਮਨੋਵਿਗਿਆਨਿਕ ਤੌਰ 'ਤੇ ਬਹੁਤ ਉਤਸ਼ਾਹਕ ਉਤਸ਼ਾਹਕ ਅਤੇ ਰੋਮਾਂਚਕ ਹੈ ਲੋਕ ਇਸਨੂੰ ਆਪਣੇ ਮਨੋਰੰਜਨ ਅਤੇ ਸ਼ਾਂਤੀ ਲਈ ਕਰਦੇ ਹਨ ਪਰ ਇਹ ਸਾਰਾ ਅਨੁਭਵ ਇੱਕ ਹੋਰ ਮਜ਼ਾ ਵਧਾਉਂਦਾ ਹੈ ਜਦੋਂ ਤੁਹਾਨੂੰ ਉਸਦੀ ਅਗਰ ਗਤੀ ਦਾ ਅਨੁਭਵ ਹੁੰਦਾ ਹੈ ਜਦੋਂ ਮੈਂ ਬਾਈਕ ਚਲਾਉਂਦਾ ਹਾਂ ਮੈਂ ਸ਼ੁਰੂ ਵਿੱਚ ਖਾਸ ਤਰ੍ਹਾਂ ਦੀ ਊਰਜਾ ਮਹਿਸੂਸ ਕਰਦਾ ਹਾਂ ਮੇਰੇ ਰਗਾਂ ਵਿੱਚ ਇੱਕ ਖਾਸ ਤਰ੍ਹਾਂ ਦੀ ਊਰਜਾ ਮਹਿਸੂਸ ਹੁੰਦੀ ਹੈ ਮੇਰੇ ਰਗਾਂ ਵਿੱਚ ਤੇਜ਼ੀ ਨਾਲ ਖੂਨ ਦੌੜਦਾ ਹੈ ਅਤੇ ਮਨ ਨੂੰ ਇੱਕ ਖਾਸ ਪ੍ਰਕਾਰ ਦੀ ਤਾਜ਼ਗੀ ਮਿਲਦੀ ਹੈ ਬਾਈਕ ਦੇ ਨਾਲ ਗਤੀ ਨੂੰ ਮਹਿਸੂਸ ਕਰਨਾ ਬੜਾ ਹੀ ਸੋਹਣਾ ਮਨਮੋਹਕ ਨਜ਼ਾਰਾ ਹੁੰਦਾ ਹੈ ਜਿਸ ਦੇ ਵਿੱਚ ਰੋਸ਼ਨੀ ਅਤੇ ਹਵਾਦਾਰ ਅਹਿਸਾਸ ਮਿਲਦਾ ਹੈ ਜੋ ਮਨੁੱਖੀ ਤਣਾਅ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ਗਤੀ ਅਤੇ ਤਿੱਖੇ ਮੋੜਾਂ ਨੂੰ ਜਦੋਂ ਵੀ ਅਸੀਂ ਪਾਰ ਕਰਦੇ ਹਾਂ ਉਹ ਬੇਤ ਉਤਸ਼ਾਹਕ ਵ ਵਾਲੇ ਪਲ ਬਣ ਜਾਂਦੇ ਹਨ ਇੱਕ ਸਰੀਰਕ ਤੌਰ 'ਤੇ ਸ਼ੁਰੂ ਹੁੰਦੀ ਹੈ ਪਰ ਮਾਨਸਿਕ ਤੌਰ 'ਤੇ ਵੀ ਬਹੁਤ ਕੁਝ ਹਾਸਲ ਹੁੰਦਾ ਹੈ ਜਿਵੇਂ ਕਿ ਦੁਨੀਆ ਤੋਂ ਅਲੱਗ ਹੋਣਾ ਅਤੇ ਪੂਰੀ ਤਰ੍ਹਾਂ ਵਿਚਾਰਾਂ ਵਿੱਚ ਡੁੱਬ ਜਾਣਾ ਬਾਈਕਿੰਗ ਸਿਰਫ ਇੱਕ ਸਧਾਰਨ ਕਸਰਤ ਨਹੀਂ ਬਲਕਿ ਉਹ ਆਪਣੇ ਆਪ ਵਿੱਚ ਖਾਸ ਅਨੁਭਵ ਹੈ ਜਿਸ ਨਾਲ ਤੁਸੀਂ ਜ਼ਿੰਦਗੀ ਦੀ ਰੂਟੀਨ ਨੂੰ ਭੁੱਲ ਭੁੱਲ ਸਕਦੇ ਹੋ ਜਦੋਂ ਮੈਂ ਖੁਦ ਬਾਈਕ ਚਲਾਉਂਦਾ ਹਾਂ ਪਹਿਲਾਂ ਹੀ ਮੇਰੇ ਮਨ ਵਿੱਚ ਇੱਕ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਮੇਰੀਆਂ ਹੱਡੀਆਂ ਵਿੱਚ ਇੱਕ ਐਡਰਨਲ ਦਰਸ਼ ਦਾ ਰਸ ਦੋੜਨ ਲੱਗ ਦੋੜਨ ਲੱਗ ਜਾਂਦਾ ਹੈ ਜੋ ਮੇਰੇ ਮਾਨਸਿਕ ਅਤੇ ਸਰੀਰਿਕ ਸਥਿਤੀ ਨੂੰ ਬਦਲ ਦਿੰਦਾ ਹੈ ਇਸ ਤਰ੍ਹਾਂ ਹਰ ਮੋੜ ਅਤੇ ਹਰ ਚੜ੍ਹਾਈ ਨਾਲ ਇੱਕ ਵੱਖਰੀ ਮਹਿਸੂਸ ਹੁੰਦੀ ਹੈ ਮੈਂ ਆਪਣੀ ਬਾਈਕ ਨੂੰ ਰਸਤੇ 'ਤੇ ਦੌੜਾਉਂਦਾ ਹਾਂ ਤਾਂ ਮੇਰੀਆਂ ਅੱਖਾਂ ਵਿੱਚ ਰੁੱਖੇ ਮੋੜ ਤੇਜ਼ ਹਵਾ ਅਤੇ ਮਿੱਟੀ ਦੀ ਖੁਸ਼ਬੂ ਹੁੰਦੀ ਹੈ ਜੋ ਮੇਰੇ ਮਨ ਨੂੰ ਬਹੁਤ ਹੀ ਖੁੱਲ੍ਹਾ ਕਰਦੀ ਹੈ ਅਤੇ ਮੇਰੇ ਮਨ ਵਿੱਚ ਆਪਸ ਵਿੱਚ ਤਾਜ਼ਗੀ ਮਹਿਸੂਸ ਕਰਦੀ ਹੈ ਅਤੇ ਬਹੁਤ ਹੀ ਮਨਮੋਹਕ ਬਣਾ ਦਿੰਦੀ ਹੈ ਇਹ ਸਾਰਾ ਅਨੁਭਵ ਅਕਸਰ ਮੈਨੂੰ ਰੋਜ਼ਮੱਰਾ ਦੀ ਜੀਵਨ ਦੀ ਟੈਨਸ਼ਨ ਤੋਂ ਦੂਰ ਲੈ ਜਾਂਦਾ ਹੈ ਜਿੱਥੇ ਮੈਂ ਆਪਣੇ ਆਪ ਨੂੰ ਖੁਦ ਖੁਦ ਦੀ ਦੁਨੀਆ ਵਿੱਚ ਮਹਿਸੂਸ ਕਰ ਸਕਦਾ ਹਾਂ